ਸਾਡੇ ਸ਼ਹਿਰ ਖਰੜ ਵਿੱਚ ਖਾਲਸਾ ਸਕੂਲ ਦੇ ਨੇੜੇ ਲਾਈਬ੍ਰੇਰੀ ਹੈ ਜਿਸ ਵਿੱਚ ਬਹੁਤ ਸਾਰੀਆਂ ਕਿਤਾਬਾਂ ਹਨ ਅਤੇ ਮੈਨੂੰ ਜਨਰਲ ਨੌਲਜ ਦੀਆਂ ਕਿਤਾਬਾਂ ਪੜ੍ਹਨ ਬਾਰੇ ਬਹੁਤ ਦਿਲ ਕਰਦਾ ਹੈ ਅਤੇ ਮੈਨੂੰ ਪੂਰੀ ਹਿੰਦੁਸਤਾਨ ਅਤੇ ਵਿਸ਼ਵ ਦੀ ਜਾਣਕਾਰੀ ਲੈਣ ਵਿੱਚ ਬਹੁਤ ਦਿਲਚਸਪੀ ਹੈ ਅਤੇ ਮੈਨੂੰ ਧਰਮ ਅਤੇ ਅ ਵਿਆਕਰਨ ਪੰਜਾਬੀ ਜਿਵੇਂ ਕਿ ਗੁਰੂਆਂ ਬਾਰੇ ਮਹਾਰਾਜਾ ਰਣਜੀਤ ਸਿੰਘ ਬਾਰੇ ਪੁਰਾਣੇ ਜੋ ਆਪਣੇ ਪੰਜਾਬ ਦੇ ਤਿਉਹਾਰ ਤਿੱਥ ਤਿਉਹਾਰ ਸੀ ਉਹਨਾਂ ਨੂੰ ਪੜ੍ਹਨ ਵਿੱਚ ਬਹੁਤ ਅਤੇ ਉਹਨਾਂ ਦੀ ਜਾਣਕਾਰੀ ਲੈਣ ਵਿੱਚ ਬਹੁਤ ਦਿਲਚਸਪੀ ਹੈ ਅਤੇ ਮੈਨੂੰ ਹੁਣ ਤੱਕ ਮੈਂ ਜਿੰਨੀਆਂ ਕਿਤਾਬਾਂ ਪੜ੍ਹੀਆਂ ਹਨ ਉਹਨਾਂ ਤੋਂ ਸਾਰੇ ਆਪਣੇ ਧਰਮ ਅਤੇ ਗੁਰੂਆਂ ਬਾਰੇ ਕਿੰਨੇ ਗ੍ਰੰਥ ਕਿੰਨੇ ਗੁਰੂਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਭਗਤਾਂ ਦੀ ਕਿੰਨੇ ਭੱਟਾਂ ਦੀ ਅਤੇ ਕਿੰਨੇ ਪੀਰਾਂ ਦੀ ਫਕੀਰਾਂ ਦੀ ਸਾਰਿਆਂ ਬਾਰੇ ਜਾਣਕੇ ਰੱਖਦਾ ਹਾਂ ਅਤੇ ਮੈਨੂੰ ਹੋਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਜਦੋਂ ਉਹਨਾਂ ਦਾ ਰਾਜ ਸੀ ਪੂਰੇ ਪੰਜਾਬ ਜਦੋਂ ਪੰਜਾਬ ਪੂਰਾ ਮਤ ਵੰਡ ਤੋਂ ਪਹਿਲਾਂ ਸੀ ਉਹਨਾਂ ਨੂੰ ਉਸ ਵੇਲੇ ਦੀ ਲੋਕਾਂ ਦੀ ਸੋਚ ਨੂੰ ਸੁਣ ਕੇ ਜਦੋਂ ਰਾਜ ਸੀ ਉਨ੍ਹਾਂ ਵਿੱਚ ਦੀਰ ਰਾਜ ਵੇਲੇ ਕੋਈ ਦੁਖੀ ਨਹੀਂ ਸੀ ਇਹ ਬਹੁਤ ਮੈਨੂੰ ਖੁਸ਼ੀ ਹੋਈ ਸੁਣ ਕੇ